ਪੰਜਾਬ ਦੀ ਇਤਿਹਾਸ ਜੋ ਹੈ ਬੜੀ ਪੁਰਾਣੀ ਹੈ ਇਤਿਹਾਸ ਵਿੱਚ ਪੰਜਾਬ ਨੇ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ ਖਾਸ ਤੌਰ 'ਤੇ ਆਮਦਨ ਦੇ ਪੱਖੋਂ ਉਦਯੋਗ ਦੇ ਪੱਖੋਂ ਪੰਜਾਬ ਹਮੇਸ਼ਾ ਹੀ ਅੱਗੇ ਰਿਹਾ ਹੈ ਮਹਾਰਾਜਾ ਰਣਜੀਤ ਕ ਸਿੰਘ ਦੇ ਸਮੇਂ ਤੋਂ ਹੀ ਪੰਜਾਬ ਵਿੱਚ ਬਹੁਤ ਸਾਰੇ ਉਦਯੋਗ ਲੱਗੇ ਅਤੇ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਸਮੇਂ ਵੀ ਪੰਜਾਬ ਵਿੱਚ ਕੱਪੜੇ ਦੇ ਹਥਿਆਰਾਂ ਦੇ ਕਾਰਖਾਨੇ ਲੱਗੇ ਅਤੇ ਲੋਹੇ ਦੇ ਕਾਰਖਾਨੇ ਲੱਗੇ ਅਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਵੀ ਪੰਜਾਬ ਵਿੱਚ ਹਰ ਤਰ੍ਹਾਂ ਦੀ ਇੰਡਸਟਰੀ ਹੈ ਅਤੇ ਹਰੇਕ ਤਰ੍ਹਾਂ ਦਾ ਜੋ ਸਮਾਨ ਹੈ ਉਹ ਬਣਦਾ ਹੈ ਖਾਸ ਤੌਰ 'ਤੇ ਲੁਧਿਆਣੇ ਨੂੰ ਜੋ ਕਿ ਸਾਡਾ ਪੰਜਾਬ ਦੇ ਬਿਲਕੁਲ ਕੇਂਦਰ ਦੇ ਵਿੱਚ ਸਭ ਤੋਂ ਵੱਡਾ ਸ਼ਹਿਰ ਹੈ ਉਸ ਨੂੰ ਉਦਯੋਗਾਂ ਪਿੱਛੋਂ ਬਹੁਤ ਮਾਨਤਾ ਮਿਲੀ ਹੈ ਸਾਈਕਲ ਦੇ ਪੁਰਜੇ ਬਣਾਉਣ ਦੀ ਜਾਂ ਮਸ਼ੀਨਾਂ ਦੇ ਟੂਲ ਬਣਾਉਣ ਦੇ ਬੜੇ ਕਾਰਖਾਨੇ ਲੁਧਿਆਣੇ ਦੇ ਵਿੱਚ ਹਨ ਮੰਡੀ ਗੋਬਿੰਦਗੜ੍ਹ ਵੀ ਇੱਕ ਵੱਡਾ ਸਥਾਨ ਹੈ ਜਿੱਥੇ ਉਦਯੋਗ ਲੱਗੇ ਹਨ ਉਦਯੋਗਾਂ ਦੇ ਵਿੱਚ ਪੰਜਾਬ ਦਾ ਬੜਾ ਵਧੀਆ ਸਥਾਨ ਹੈ ਪੰਜਾਬ ਇਹ ਖੇਤੀਬਾੜੀ ਨਾਲ ਸਬੰਧਤ ਸੂਬਾ ਵੀ ਹੈ ਕਿਉਂਕਿ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਇੱਥੇ ਕਣਕ ਝੋਨਾ ਗੰਨਾ ਕਪਾਹ

ਕਿਨੂੰ ਇਹ ਵੀ ਇੱਥੇ ਉਗਾਏ ਜਾਂਦੇ ਨੇ ਅਮਰੂਦ ਵੀ ਇੱਥੇ ਬਹੁਤ ਚੰਗਾ ਹੁੰਦਾ ਹੈ ਤਾਂ ਉਹ ਵਪਾਰ ਦੇ ਰੂਪ ਵਿੱਚ ਵੀ ਪੰਜਾਬ ਦਾ ਇੱਕ ਚੰਗਾ ਨਾਂ ਹੈ ਵੱਡੇ ਵੱਡੇ ਵਪਾਰੀ ਇੱਥੇ ਰਹਿੰਦੇ ਹਨ ਇਸ ਤਰ੍ਹਾਂ ਪੰਜਾਬ ਦੀ ਖੇਤੀ ਸੰਨਤ ਅਤੇ ਵਪਾਰ ਪੱਖੋਂ ਚੰਗਾ ਖੁਸ਼ਹਾਲ ਸੂਬਾ ਹੈ ਪਰ ਹੁਣ ਦੇ ਸਮੇਂ ਵਿੱਚ ਕਈ ਕਾਰਨਾਂ ਕਰਕੇ ਆਰਥਿਕ ਤੌਰ 'ਤੇ ਅਸੀਂ ਪਛੜ ਰਹੇ ਹਾਂ ਸਾਨੂੰ ਹੋਰ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਇੱਕ ਚੰਗਾ ਸੂਬੇ ਵਜੋਂ ਵਿਕਸਿਤ ਹੋ ਸਕੇ